ਹੈਲੋ ਵਰਸ਼ਾ ਕਿਵੇਂ ਹੈ ਬਸ ਮੈਂ ਵੀ ਵਧੀਆ ਬਸ ਘਰ ਘੁਰ ਦੇ ਕੰਮ ਕਰਦੇ ਨਹੀਂ ਮੁੱਕਦੇ ਹੈਗੇ ਹੋਰ ਕੀ ਹਾਲ ਕੀ ਸੁਣਾਵਾਂ ਹੋਰ ਕੀ ਹੋਰ ਕੀ ਯਾਰ ਮੈਂ ਨਾ ਹਾਂ ਰਾਜ ਵੀ ਵਧੀਆ ਹੈ ਅਤੇ ਉਹਦੇ ਮਤਲਬ ਰਿਲੇਟਿਡ ਹੀ ਤੈਨੂੰ ਕੋਲ ਕੀਤੀ ਆ ਮੈਂ ਉਹ ਉਹ ਨਾ ਛੇਵੀਂ 'ਚ ਹੁਣ ਉਹਨੇ ਪੰਜਵੀਂ ਪਾਸ ਕਰ ਲਈ ਆਪਣੀ ਹੈ ਨਾ ਅਤੇ ਜਿਹੜੇ ਛੇਵੀਂ 'ਚ ਉਹਨੂੰ ਮੈਂ ਲਗਾਣਾ ਨਵੇਂ ਸਕੂਲ ਤੇ ਕਿਉਂਕਿ ਪੰਜਵੀਂ ਤੱਕ ਹੀ ਇੱਥੇ ਸਕੂਲ ਅਤੇ ਮੈਂ ਸੋਚਦੀ ਸੀ ਪਟਿਆਲੇ ਕਰਾਂ ਪਰ ਮੈਨੂੰ ਪਟਿਆਲੇ ਇਹ ਨਹੀਂ ਪਤਾ ਕਿ ਕਿਹੜੇ ਕਿਹੜੇ ਸਕੂਲ ਵਧੀਆ ਨੇ ਤੈਨੂੰ ਤੂੰ ਦੱਸ ਸਕਦੀ ਆਂ ਤਾਂ ਦੱਸ ਮੈਨੂੰ ਤੂੰ ਪਟਿਆਲੇ ਤਾਂ ਰਹਿੰਦੀ ਆਂ ਹਮ ਹਮ ਹਮ

ਹਮ ਹਮ ਹਮ ਓਕੇ ਹਮ ਹਮ ਹਮ ਓਕੇ ਅਤੇ ਉਹਨਾਂ ਦਾ ਮਤਲਬ ਫੀਸ ਸਟਕਚਰ ਤੈਨੂੰ ਅਗਰ ਪਤਾ ਹੋਵੇ ਜਾਂ ਫਿਰ ਤੂੰ ਕਿਸੇ ਤੋਂ ਪਤਾ ਕਰਕੇ ਮੈਨੂੰ ਵਟਸਐਪ ਕਰ ਸਕਦੀ ਹੈ ਅਤੇ ਨਾਲੇ ਇਹ ਵੀ ਦੱਸਦੀ ਮੈਨੂੰ ਕਿ ਐਕਟੀਵਿਟੀਜ਼ ਹੁੰਦੀਆਂ ਨੇ ਉਹਦੇ ਵਿੱਚ ਕਿਉਂਕਿ ਹੁਣ ਖੇਡਣਾ ਖੇਡਣਾ ਵੀ ਜ਼ਰੂਰੀ ਹੈ ਭਲਾ ਹਾਂ ਓਕੇ ਫਿਰ ਇੱਕ ਕੰਮ ਕਰਦੇ ਹਾਂ ਤੂੰ ਨਾ ਮੈਨੂੰ ਜੇ ਅਗਰ ਕੋਸ਼ਿਸ਼ ਹੋਵੇ ਕਿ ਤਿੰਨ ਜਿਹੜੇ ਤਿੰਨ ਚਾਰ ਨੇ ਉਹਨਾਂ ਸਾਰਿਆਂ ਦੇ ਫੀਸ ਸਟਕਚਰ ਭੇਜਦੀ ਮੈਂ ਨਾ ਇੱਕ ਵਾਰੀ ਜਾਣਾ ਹੈਗਾ ਉੱਤੇ ਇੱਕ ਵਾਰ ਨਾ ਜਾ ਕੇ ਉੱਥੇ ਪਤਾ ਕਰ ਲਉਂਗੀ ਕਿ ਉਹਨਾਂ ਦਾ ਐਕਟੀਵਿਟੀਜ਼ ਕੀ ਨੇ ਪ੍ਰੋਗ ਹੈ ਨਾ ਕੀ ਕੀ ਹੁੰਦਾ ਉਹਦੇ ਵਿੱਚ ਫਿਰ ਮੈਂ ਦੇਖ ਲਾਂਗੀ ਠੀਕ ਹੈ ਹਾਂ ਫਿਰ ਮੈਂ ਤੈਨੂੰ ਨਾਲੇ ਉਸ ਦਿਨ ਮਿਲਾਂਗੀ ਵੀ ਠੀਕ ਆ ਉਸ ਦਿਨ ਹੀ ਮਿਲਦੇ ਹਾਂ ਫਿਰ ਆਪਾਂ ਓਕੇ ਬਾਏ ਬਾਏ ਬਾਏ